ਹਾਂ ਜੀ ਹਾਂ ਐੱਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਸੁਰੱਖਿਆ ਸਾਵਧਾਨੀਆਂ ਬਹੁਤ ਜ਼ਰੂਰੀ ਹਨ ਕੁਝ ਮਹੱਤਵਪੂਰਨ ਸਾਵਧਾਨੀਆਂ ਇਹ ਹਨ ਜਿਵੇਂ ਕਿ ਸਿਲੰਡਰ ਦੀ ਜਾਂਚ ਹਮੇਸ਼ਾ ਸਿਲੰਡਰ ਦੀ ਜਾਂਚ ਕਰੋ ਕਿ ਉਸ ਵਿੱਚ ਕੋਈ ਲੀਕੇਜ ਤਾਂ ਨਹੀਂ ਜਦੋਂ ਅਸੀਂ ਗੈਸ ਅਜੰਸੀ ਵਿੱਚੋਂ ਸਿਲੰਡਰ ਲੈਕਰ ਆਉਂਦੇ ਹਾਂ ਤਾਂ ਸਾਨੂੰ ਪਹਿਲਾਂ ਉਸ ਸਿਲੰਡਰ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ ਕਿ ਉਹ ਲੀਕੇਜ ਤਾਂ ਨਹੀਂ ਅਤੇ ਉਸਦਾ ਭਾਰ ਵੀ ਕਰਨਾ ਚਾਹੀਦਾ ਹੈ ਅਤੇ ਸਿਲੰਡਰ ਦੀ ਦੂਸਰੀ ਜਾਣਕਾਰੀ ਵੈਂਟੀਲੇਸ਼ਨ ਖਾਣਾ ਪਕਾਉਂਦੇ ਸਮੇਂ ਰਸੋਈ ਵਿੱਚ ਹਵਾ ਦਾ ਆਉਣਾ ਯਕੀਨੀ ਬਣਾਓ ਰੈਗੂਲੇਟਰ ਦੀ ਜਾਂਚ ਰੈਗੂਲੇਟਰ ਨੂੰ ਸਹੀ ਤਰੀਕੇ ਨਾਲ ਲਗਾਓ ਅਤੇ ਯਕੀਨੀ ਬਣਾਓ ਕੀ ਇਹ ਚੰਗੀ ਹਾਲਤ ਵਿੱਚ ਹੈ ਜਾਂ ਨਹੀਂ ਸਿਲੰਡਰ ਨੂੰ ਸਿੱਧਾ ਰੱਖੋ ਸਾਡੇ ਘਰਾਂ ਵਿੱਚ ਜ਼ਿਆਦਾਤਰ ਔਰਤਾਂ ਜਾਂ ਮਰਦ ਖਾਣਾ ਪਕਾਉਂਦੇ ਸਮੇਂ ਜਦੋਂ ਸਿਲੰਡਰ ਖਤਮ ਹੋ ਜਾਂਦਾ ਹੈ ਤਾਂ ਉਸ ਨੂੰ ਉਲਟਾ ਕਰਕੇ ਰੱਖ ਦਿੰਦੇ ਹਨ ਪਰ ਇਹ ਸੱਚ ਨਹੀਂ ਹੈ ਸੱਚ ਇਹ ਹੈ ਕਿ ਜੇਕਰ ਸਿਲੰਡਰ ਨੂੰ ਹਮੇਸ਼ਾ ਸਿੱਧਾ ਰੱਖਾਂਗੇ ਤਾਂ ਉਹ ਸਹੀ ਕੰਮ ਕਰੇਗਾ ਜੇਕਰ ਸਿਲੰਡਰ ਨੂੰ ਉਲਟਾ ਕਰਾਂਗੇ ਤਾਂ ਉਹ ਫਟਣ ਦੇ ਡਰ ਵਿੱਚ ਵੀ ਹੈ ਅੱਗ ਤੋਂ ਦੂਰ ਰੱਖੋ ਸਿਲੰਡਰ ਨੂੰ ਕਿਸੇ ਵੀ ਕਿਸਮ ਦੀ ਅੱਗ ਜਾਂ ਗਰਮੀ ਦੇ ਸਰੋਤ ਤੋਂ ਹਮੇਸ਼ਾ ਦੂਰ ਰੱਖੋ ਕਿਉਂਕਿ ਉਸ ਵਿੱਚ ਐੱਲ ਪੀ ਜੀ ਗੈਸ ਹੁੰਦੀ ਹੈ ਜੋ ਕਿ ਆਕਸੀਜਨ ਦੇ ਸੰਪਰਕ ਵਿੱਚ ਆ ਕੇ ਛੇਤੀ ਅੱਗ ਫੜ ਲੈਂਦੀ ਹੈ ਅਤੇ ਅੱਗ ਹੀ ਅੱਗ ਨੂੰ ਬਹੁਤ ਜਲਦ ਹੀ ਫੜਦੀ ਹੈ ਇਸ ਲਈ ਸਿਲੰਡਰ ਨੂੰ ਅੱਗ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਉਸ ਨੂੰ ਗਰਮੀ ਦੇ ਸਰੋਤ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ ਬੱਚਿਆਂ ਤੋਂ ਦੂਰ ਰੱਖੋ ਸਿਲੰਡਰ ਨੂੰ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਬੱਚੇ ਜ਼ਿਆਦਾ ਸ਼ਰਾਰਤ ਕਰਦੇ ਸਮੇਂ ਰੈਗੂਲੇਟਰ ਜਾਂ ਗੈਸ ਓਨ ਵੀ ਕਰ ਸਕਦੇ ਹਨ ਜਿਸ ਨਾਲ ਕੋਈ ਘਰ ਵਿੱਚ ਹਾਨੀ ਪ ਪਹੁੰਚ ਸਕਦੀ ਹੈ ਇਸ ਲਈ ਬੱਚਿਆਂ ਨੂੰ ਗੈਂਸ ਤੋਂ ਦੂਰ ਰੱਖਣਾ ਲਾਜ਼ਮੀ ਹੈ